ਸਤਿ ਸ਼੍ਰੀ ਅਕਾਲ ਮੈਂ ਪ੍ਰੀਆ ਜੀ ਹਾਂ ਮੈਂ ਧਾਰਮਿਕ ਪੁਸਤਕਾਂ ਬਹੁਤ ਸਾਰੀਆਂ ਪੜ੍ਹੀਆਂ ਹਨ ਬਟ ਮੈਂ ਕਬੀਰ ਦਾਸ ਜੀ ਦੀਆਂ ਪੁਸਤਕਾਂ ਨੂੰ ਪੜ੍ਹਨਾ ਪਸੰਦ ਕਰਦੀ ਹਾਂ ਉਹਨਾਂ ਦੀਆਂ ਕਈ ਬਾਣੀਆਂ ਹਨ ਅਤੇ ਉਹਨਾਂ ਵਿੱਚੋਂ ਕਈ ਮੈਨੂੰ ਯਾਦ ਵੀ ਹਨ ਪਰ ਮੈਂ ਤੁਹਾਡੇ ਨਾਲ ਇੱਕ ਸਲੋਕ ਜਿਹੜਾ ਹੈ ਉਹ ਸਾਂਝਾ ਕਰਨਾ ਚਾਹੁੰਦੀ ਹਾਂ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਇ ਜੋ ਮਨ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਇ ਜਿਸ ਦਾ ਅਰਥ ਹੈ ਕਿ ਜਦੋਂ ਮੈਂ ਦੂਜਿਆਂ ਵਿੱਚ ਬੁਰਾਈਆਂ ਦੇਖਣਾ ਚ ਦੇਖਣ ਗਿਆ ਤਾਂ ਮੈਨੂੰ ਕਿਸੇ ਵਿੱਚ ਕੋਈ ਬੁਰਾਈ ਨਹੀਂ ਮਿਲੀ ਪਰ ਜਦੋਂ ਮੈਂ ਆਪਣਾ ਮਨ ਖੋਜਿਆ ਤਾਂ ਮੈਨੂੰ ਬਹੁਤ ਬੁਰਾਈਆਂ ਹੀ ਬੁਰਾਈਆਂ ਮਿਲੀਆਂ ਧੰਨਵਾਦ ਜੀ